ਹਾਂਜੀ ਚੌਵੀ ਘੰਟਿਆਂ ਦੇ ਵਿੱਚੋਂ ਚਾਰ ਘੰਟੇ ਦਾ ਕੱਟ ਲੱਗਦਾ ਬਿਜਲੀ ਦਾ ਅਤੇ ਜਿਹਦੇ ਨਾਲ ਗਰਮੀ ਬਹੁਤ ਜ਼ਿਆਦਾ ਲੱਗਦੀ ਹੈ ਅਤੇ ਪਾਣੀ ਦੀ ਵੀ ਬਹੁਤ ਦਿੱਕਤ ਆਉਂਦੀ ਹੈ ਅਤੇ ਫਿਰ ਮੈਂ ਵੀ ਸਿਲਾਈ ਵੀ ਕਰਦੀ ਹਾਂ ਸਿਲਾਈ ਮੋਟਰ 'ਤੇ ਕਰਦੀ ਹਾਂ ਕਿਉਂਕਿ ਮੇਰੀ ਮੋਟਰ ਵੀ ਨਹੀਂ ਚੱਲਦੀ ਹੈਗੀ ਅਤੇ ਤਾਂ ਕਰਕੇ ਮੈਂ ਅਗਲੇ ਦਾ ਸੂਟ ਜ਼ਰੂਰੀ ਦੇਣਾ ਹੁੰਦਾ ਗਰਮੀ ਵੀ ਗਰਮੀ ਬਹੁਤ ਹੋ ਜਾਂਦੀ ਹੈਗੀ ਹੈ ਤਾਂ ਕਰਕੇ ਫਿਰ ਮੈਨੂੰ ਵੀ ਬਹੁਤ ਔਖਾ ਹੁੰਦਾ ਹੈ ਹਾਂ ਪਾਣੀ ਪਾਣੀ ਦੀ ਤਾਂ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ